ਜੇ ਆਪਾਂ ਗੱਲ ਕਰੀਏ ਤਾਂ ਆਪਾਂ ਨੂੰ ਹੈ ਨਾ ਸਰਕਾਰ ਵੱਲੋਂ ਚਲਾਏ ਗਏ ਪਿੰਡਾਂ ਦੇ ਕੋਈ ਨਾ ਪ੍ਰੋਗਰਾਮਾਂ ਦੀ ਜਾਣਕਾਰੀ ਲੈਣੀ ਹੋਵੇ ਤਾਂ ਆਪਾਂ ਨੂੰ ਜ਼ਿਆਦਾ ਸਰਪੰਚ ਪੰਚਾਂ ਕੋਲੋਂ ਮਿਲੇਗੀ ਜਾਂ ਫਿਰ ਬੈਂਕ ਦੇ ਅਫਸਰ ਪਿੰਡ ਦੇ ਵਿੱਚ ਲੋਕਾਂ ਨੂੰ ਇਕੱਠਾ ਕਰਕੇ ਜਾਣਕਾਰੀ ਦਿੰਦੇ ਹਨ ਜਾਂ ਫਿਰ ਆਪਣੇ ਜ਼ਿਲਿਆਂ ਦੇ ਅੰਦਰੋਂ ਅਫਸਰ ਆਉਂਦੇ ਹਨ ਜੋ ਕਿ ਪੰਚਾਂ ਸਰਪੰਚ ਜਾਂ ਆਪਣੇ ਗੁਰਦੁਆਰਿਆਂ ਵਿੱਚ ਅਨਾਊਂਸ ਕਰਵਾ ਕੇ ਸਾਰੇ ਪਿੰਡ ਦੇ ਵਿਅਕਤੀਆਂ ਅਤੇ ਜਨਾਨੀਆਂ ਸਾਰੇ ਵਿਅਕਤੀਆਂ ਨੂੰ ਇਕੱਠਾ ਕਰਕੇ ਉਹਨਾਂ ਚੀਜ਼ਾਂ ਬਾਰੇ ਜਾਣਕਾਰੀ ਦਿੰਦੇ ਹਨ ਅਤੇ ਸਾਨੂੰ ਪੈਪਲੇਟਸ ਵੀ ਵੰਡਦੇ ਹਨ ਤਾਂ ਜੋ ਸਾਨੂੰ ਇਸ ਚੀਜ਼ ਬਾਰੇ ਜ਼ਿਆਦਾ ਤੋਂ ਜਾਂ ਜ਼ਿਆਦਾ ਜਾਣਕਾਰੀ ਮਿਲ ਸਕੇ ਇਹਨਾ ਚੀਜ਼ਾਂ ਨਾਲ ਤਾਂ ਜੋ ਪਿੰਡ ਦੇ ਵਿੱਚ ਪੜ੍ਹ ਰਹੇ ਬੱਚੇ ਜਾਂ ਨੌਜਵਾਨ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਮਿਲ ਸਕੇ ਅਤੇ ਉਹ ਆਪਣਾ ਵਧੀਆ ਭਵਿੱਖ ਬਣਾ ਸਕਣ ਅਤੇ ਗੱਲ ਕਰੀਏ ਜੇ ਆਪਣੇ ਪਿੰਡਾਂ ਦੇ ਵਿੱਚ ਹੈ ਨਾ ਜਿਹੜੇ ਪ੍ਰੋਗਰਾਮਸ ਚੱਲ ਰਹੇ ਨੇ ਐਜੂਕੇਸ਼ਨ ਦੇ ਲਈ ਜਿਦਾਂ ਕਿ ਹੁਣ ਪ੍ਰ ਪ੍ਰਧਾਨ ਮੰਤਰੀ ਯੋਜਨਾ ਦੇ ਵਿੱਚ ਕੰਪਿਊਟਰ ਸੈਂਟਰਸ ਦੇ ਛੇ ਛੇ ਮਹੀਨੇ ਜਾਂ ਤਿੰਨ ਤਿੰਨ ਮਹੀਨਿਆਂ ਦੇ ਕੋਰਸਿਸ ਚਲਾਏ ਗਏ ਨੇ ਤਾਂ ਜੋ ਕੁੜੀਆਂ ਵਧੀਆ ਐਜੂਕੇਸ਼ਨ ਲੈ ਕੇ ਆਪਣਾ ਵਧੀਆ ਫਿਊਚਰ ਬਣਾ ਸਕਣ ਮੈਂ ਵੀ ਇੱਕ ਇੱਦਾਂ ਦੇ ਹੀ ਸੈਂਟਰ ਦੇ ਵਿੱਚ ਕੰਮ ਕਰ ਕੰਮ ਕਰਦੀ ਹਾਂ ਮੈਂ ਪ੍ਰਧਾਨ ਮੰਤਰੀ ਯੋਜਨਾ ਦੇ ਅਧੀਨ ਚੱਲ ਰਹੇ ਕੰਪਿਊਟਰ ਕੋਰਸ ਸੈਂਟਰ ਦੇ ਵਿੱਚ ਕੰਪਿਊਟਰ ਕੋਰਸ ਸਿੱਖ ਰਹੀ ਹਾਂ ਅਤੇ ਇਹ ਚੀਜ਼ਾਂ ਬਹੁਤ ਹੀ ਜ਼ਿਆਦਾ ਵਧੀਆ ਲਾਭਦਾਇਕ ਅਤੇ ਫਾਇਦੇਮੰਦ ਹਨ ਅਤੇ ਇਹਨਾਂ ਦੀ ਫੀਸ ਵੀ ਨਹੀਂ ਹੁੰਦੀ ਅਤੇ ਇਹਨਾਂ ਚੀਜ਼ਾਂ ਨਾਲ ਬਹੁਤ ਹੀ ਪਿੰਡਾਂ ਦੀਆਂ ਗਰੀਬ ਕੁੜੀਆਂ ਦਾ ਫਾਇਦਾ ਹੁੰਦਾ ਹੈ